ਮਨੈਂਜਰ ਸਾਹਿਬ ਇੱਧਰ ਆਓ ਸਰ ਅਸੀਂ ਪੂਰੇ ਪਰਿਵਾਰ ਲਈ ਭੋਜਨ ਦਾ ਆਡਰ ਦਿੱਤਾ ਹੈ ਤੁਸੀਂ ਉਸ ਆਡਰ ਦੀ ਇੱਕ ਰਿਕਾਰਡ ਦੀ ਫੋਟੋਕਾਪੀ ਸਾਨੂੰ ਦਿਓ ਤਾਂ ਜੋ ਪੈਸੇ ਦੇਖ ਸਕਾਂ ਕਿ ਕਿਸ ਭੋਜਨ ਦੇ ਕਿੰਨੇ ਪੈਸੇ ਹਨ ਤਾਂ ਜੋ ਮੈਂ ਸਾਰੇ ਪੈਸੇ ਸਹੀ ਢੰਗ ਨਾਲ ਦੇ ਸਕਾਂ ਪੈਸੇ ਦੀ ਅਦਾਇਗੀ ਲਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਸਾਨੂੰ ਇਹ ਪਤਾ ਵੀ ਲੱਗ ਜਾਵੇਗਾ ਕਿ ਕਿਹੜਾ ਟੇਬਲ ਅਤੇ ਕਿਹੜੇ ਭੋਜਨ ਦੀ ਬੁਕਿੰਗ ਹੋਈ ਹੈ ਮਨੈਂਜਰ ਸਾਹਿਬ ਨੇ ਵੀ ਆਪਣੀ ਜਲਦੀ ਆਪਣਾ ਕੰਮ ਖਤਮ ਕਰਨਾ ਹੁੰਦਾ ਹੈ ਮੈਂ ਵੀ ਜਲਦੀ ਹੀ ਵਿਹਲਾ ਹੋ ਸਕਾਂਗੀ ਅਤੇ ਇਸ ਨਾਲ ਸਾਨੂੰ ਹਰ ਇੱਕ ਚੀਜ਼ ਦਾ ਪਤਾ ਚੱਲਦਾ ਹੈ ਕਿ ਕਿਹੜੀ ਚੀਜ਼ ਦਾ ਠੀਕ ਮੁੱਲ ਲੱਗਾ ਹੈ ਤੁਹਾਡੀ ਮਿਹਰਬਾਨੀ ਹੋਵੇਗੀ ਜੇਕਰ ਤੁਸੀਂ ਮੇਰੀ ਇਸ ਭੋਜਨ ਦੀ ਰਸੀਦ ਸਮੇਂ ਸਿਰ ਦੇ ਦਿਓ